ਅਸੀਂ ਜੀ ਇਹਨਾਂ ਤੋਂ ਪਸ਼ੂਆਂ ਤੋਂ ਬੈਲ ਵਗੈਰਾ ਤੋਂ ਕੰਮ ਲੈਂਦੇ ਹਾਂ ਖੇਤੀਬਾੜੀ ਦਾ ਠੀਕ ਹੈ ਜੀ ਜਿਵੇਂ ਵਾਹੀ ਵਗੈਰਾ ਕਰਨੀ ਇਹਨਾਂ ਤੋਂ ਕੰਮ ਲੈਂਦੇ ਹਾਂ ਆਪਾਂ ਵਾਹੁਣਾ ਬੀਜਣਾ ਠੀਕ ਹੈ ਜੀ ਇੱਦਾਂ ਉਹ ਕਰਨਾ ਅਤੇ ਬਾਕੀ ਇਹਨਾਂ ਦੀ ਮੰਨ ਲਾ ਵੀ ਉਹ ਬਣਾਉਂਦੇ ਇਹਨਾਂ ਦੀ ਗੋਹੇ ਤੋਂ ਵਗੈਰਾ ਮਤਲਬ ਵੀ ਖਾਦ ਬਣਾਉਂਦੇ ਜਿਹੜੇ ਅਸੀਂ ਖੇਤ ਪਾਉਂਦੇ ਹਾਂ ਠੀਕ ਹੈ ਜੀ ਇਹਨ ਬੈਲ ਵਗੈਰਾ ਨੇ ਇਹਦੇ ਨਾਲ ਹੀ ਢੋਂਦੇ ਹਾਂ ਅਸੀਂ ਖੇਤ ਉੱਥੇ ਖੇਤ ਇਹਦੇ ਨਾਲ ਯਾਨੀ ਕੇ ਇੱਕ ਥਾਂ ਜਾ ਕੇ ਢੇਰੀ ਲਾ ਲਈ ਦੀ ਠੀਕ ਹੈ ਜੀ ਬਾਕੀ ਓੱਥੇ ਮਤਲਬ ਜਦੋਂ ਫ਼ਸਲ ਵਗੈਰਾ ਕੱਟੀ ਜਾਂਦੀ ਹੈ ਦੁਬਾਰੇ ਅਸੀਂ ਇਹਨਾਂ ਨੂੰ ਹੀ ਠੀਕ ਹੈ ਜੀ ਇਹਦੇ ਨਾਲ ਹੀ ਮਤਲਬ ਅਸੀਂ ਮਤਲਬ ਭਰ ਭਰ ਕੇ ਮਤਲਬ ਗੱਡੀ ਵਗੈਰਾ 'ਤੇ ਪਾ ਕੇ ਇਹਦੇ ਨਾਲ ਖਿੱਚ ਕੇ ਬੈਲ ਵਗੈਰਾ ਨਾਲ ਭਰ ਕੇ ਮਤਲਬ ਖੇਤਾਂ ਦੇ ਵਿੱਚ ਕਿਆਰੇ ਕਿਆਰੇ 'ਚ ਅਸੀਂ ਪਾਉਂਦੇ ਹਾਂ ਖਾਦ ਇਹਨਾਂ ਦੀ ਅਤੇ ਜਿਸ ਤਰ੍ਹਾਂ ਇਹਨਾਂ ਇਹਨਾਂ ਤੋਂ ਮੰਨ ਲਾ ਵੀ ਖੇਤੋਂ ਮੰਨ ਲਾ ਵੀ ਨੀਰਾ ਵਗੈਰਾ ਇਸ ਲਿਆਉਣਾ ਜੀ ਬਾਕੀ ਹੋਰ ਇਹਨਾਂ ਤੋਂ ਮੰਨ ਲਾ ਬਜ਼ਾਰੋਂ ਕੋਈ ਸਮਾਨ ਲੈ ਕੇ ਆਉਣਾ ਬੈਲ ਵਗੈਰਾ 'ਤੇ ਲੈ ਕੇ ਆਉਂਦੇ ਹਾਂ ਠੀਕ ਹੈ ਜਿਵੇਂ ਆਪਣੇ ਹੁਣ ਸਮਾਨ ਹੋ ਗਿਆ ਘਰ ਦੇ ਅਤੇ ਅਸੀਂ ਇਹਨਾਂ ਤੋਂ ਇਸ ਤੋਂ ਲੈ ਕੇ ਆਉਂਦੇ ਹਾਂ ਜੀ ਅਤੇ ਬੈਲ 'ਤੇ ਹੀ ਲੈ ਕੇ ਆਉਂਦੇ ਹਾਂ ਮਤਲਬ ਇਹਨਾਂ ਪਸ਼ੂਆਂ ਤੋਂ ਹੀ ਅਤੇ ਇੱਦਾਂ ਵਗੈਰਾ ਹੀ ਕਰਦੇ ਹਾਂ ਜੀ ਥੈਂਕ ਯੂ ਜੀ ਸਰ